ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਨਾ ਤੁਹਾਡਾ ਨੰਬਰ ਲਿੱਤਾ ਸੀਗਾ ਟੂਰ ਐਂਡ ਟਰੈਵਲ ਵਾਲੇ ਗੱਲ ਕਰ ਰਹੇ ਨਾ ਤੁਸੀਂ ਅਤੇ ਮੈਂ ਇਹ ਪਤਾ ਕਰਨਾ ਸੀਗਾ ਵੀ ਅਸੀਂ ਨਾ ਮਕਲੋੜਗੰਜ ਜਾਣਾ ਹੈਗਾ ਅਤੇ ਦੋ ਦਿਨ ਦਾ ਟ੍ਰਿੱਪ ਹੈ ਸਾਡਾ ਅਸੀਂ ਚਾਰ ਕੁ ਜ ਜਾਣੇ ਹੈਗੇ ਹਾਂ ਅਤੇ ਸ਼ਾਇਦ ਇੱਦਾਂ ਲੱਗਦਾ ਵੀ ਛੇ ਕੁ ਜਾਣੇ ਵੀ ਹੋ ਸਕਦੇ ਹਾਂ ਅਤੇ ਤੁਸੀਂ ਸਾਨੂੰ ਅਗਰ ਦੱਸ ਦਿਓਗੇ ਵੀ ਦੋ ਦਿਨ ਦਾ ਮਕਲੋੜਗੰਜ ਚਾਰ ਜਣਿਆਂ ਵਾਲੀ ਜਿਹੜੀ ਕੈਬ ਹੋਵੇਗੀ ਉਹ ਕਿੰਨਾ ਤੁਸੀਂ ਆਪਣਾ ਖ਼ਰਚਾ ਲਓਗੇ ਅਤੇ ਜਿਹੜੀ ਛੇ ਜਣਿਆਂ ਦੀ ਹੋਵੇਗੀ ਉਹਦਾ ਵੀ ਦੱਸ ਦਿਓ ਅੱਛਾ ਤੁਸੀਂ ਚਾਰ ਜਣਿਆਂ ਦਾ ਮੈਨੇ ਪਤਾ ਕੀਤਾ ਸੀਗਾ ਅਤੇ ਚਾਰ ਜਣਿਆਂ ਦਾ ਉਹ ਕਹਿ ਰਹੇ ਸੀਗੇ ਵੀ ਜੇ ਤੁਸੀਂ ਦੋ ਦਿਨ ਲਈ ਜਾਂਦੇ ਹੋ ਤਾਂ ਮਤਲਬ ਪੰਦਰਾਂ ਕੁ ਹਜ਼ਾਰ ਹੋ ਜਾਂਦਾ ਦੋ ਦਿਨ ਦਾ ਚਾਰ ਜਣਿਆਂ ਵਾਲੀ ਗੱਡੀ ਲਈ ਅਤੇ ਜੇ ਛੇ ਜਣਿਆਂ ਲਈ ਜਾਂਦੇ ਹੋ ਤਾਂ ਉਹਨਾਂ ਨੇ ਫਿਰ ਸਾਨੂੰ ਤੀਹ ਕੁ ਹਜ਼ਾਰ ਦਾ ਦੱਸਿਆ ਸੀਗਾ ਐਸਟੀਮੇਟ ਵੀ ਚਲੋ ਤੀਜਾ ਦਿਨ ਵੀ ਤੁਹਾਡਾ ਵਿੱਚ ਇੰਕਲੂਡ ਹੋ ਜਾਵੇਗਾ ਪਰ ਇੱਦਾਂ ਵੀ ਮਤਲਬ ਮੈਨੂੰ ਥੋੜ੍ਹਾ ਜਿਹਾ ਇਹ ਜ਼ਿਆਦਾ ਲੱਗਿਆ ਅਤੇ ਮੈਂ ਤੁਹਾਨੂੰ ਇਸ ਲਈ ਫੋਨ ਕਰ ਰਹੀ ਸੀ ਸੀ ਮਤਲਬ ਦੋ ਤਿੰਨ ਜਗ੍ਹਾ ਤੋਂ ਪਤਾ ਕਰ ਲਿਆ ਇੱਕ ਵਾਰੀ ਐਨਾਲੇਸਿਸ ਹੋ ਜਾਵੇਗਾ ਵੀ ਕਿਸ ਤਰ੍ਹਾਂ ਹਿਸਾਬ ਕਿਤਾਬ ਪੈਂਦਾ ਅਤੇ ਤੁਸੀਂ ਮੈਨੂੰ ਪਲੀਜ਼ ਇੱਕ ਵਾਰੀ ਸਾਰੀ ਇਨਫੋਰਮੇਸ਼ਨ ਦੱਸ ਦੇਣਾ ਜੀ ਧੰਨਵਾਦ